ਨਹੀਂ ਮੈਂ ਕਦੇ ਕਿਸੇ ਨੂੰ ਬੁਣਨਾ ਅਤੇ ਸਿਲਾਈ ਕਰਨਾ ਨਹੀਂ ਸਿਖਾਇਆ ਬਲਕਿ ਮੈਂ ਸਿੱਖਿਆ ਹੀ ਆ ਜੋ ਮੇਰੇ ਦਾਦੀ ਜੀ ਸੀ ਉਹ ਕੀ ਕਰਦੇ ਸੀ ਕਿ ਆਪਣੀ ਸਵੈਟਰ ਜਿਹੜੀ ਉਹ ਆਪਣੇ ਆਪ ਹੀ ਉਣਦੇ ਸੀ ਅਤੇ ਉਹਨਾਂ ਨੂੰ ਵੇਖ ਕੇ ਮੇਰਾ ਵੀ ਇਹ ਸਿੱਖਣ ਨੂੰ ਜੀ ਦਿਲ ਕੀਤਾ ਅਤੇ ਮੈਂ ਉਹਨਾਂ ਕੋਲ ਥੋੜ੍ਹੇ ਸਮੇਂ ਲਈ ਜਿਹੜੇ ਸੀ ਉਹ ਚੀਜ਼ ਸਿੱਖਣੀ ਸ਼ੁਰੂ ਕੀਤੀ ਅਤੇ ਉਹ ਕਰਦੇ ਕਰਦੇ ਮੈਨੂੰ ਉਹਦੀ ਜਾਂਚ ਵੀ ਆ ਗਈ ਅਤੇ ਉਹ ਬਹੁਤ ਵਧੀਆ ਵੀ ਲੱਗਾ ਅਤੇ ਇਸ ਤਰ੍ਹਾਂ ਮੈਂ ਇੱਕ ਸਵੈਟਰ ਜਿਹੜੀ ਸੀਗੀ ਉਹ ਆਪਣੇ ਆਪ ਤਿਆਰ ਕੀਤੀ ਸੀ ਉਹਨਾਂ ਦੀ ਮਦਦ ਦੇ ਨਾਲ ਇਸ ਤੋਂ ਇਲਾਵਾ ਜਿਹੜੇ ਮੇਰੇ ਮੰਮਾ ਹੈ ਉਹ ਸਿਲਾਈ ਦਾ ਕੰਮ ਕਰਦੇ ਆ ਅਤੇ ਉਹਨਾਂ ਨੂੰ ਵੇਖ ਕੇ ਮੇਰਾ ਸਿਲਾਈ ਕਰਨ ਨੂੰ ਵੀ ਦਿਲ ਕੀਤਾ ਅਤੇ ਮੈਂ ਸਿਲਾਈ ਉਹਨਾਂ ਤੋਂ ਸਿੱਖੀ ਜਿਹੜੀ ਮੈਂ ਹੁਣ ਵੀ ਕਰਦੀ ਹਾਂ ਪਰ ਜੋ ਬੁਣਾਈ ਦਾ ਕੰਮ ਸੀਗਾ ਉਹ ਮੈਂ ਮਤਲਬ ਕਿ ਛੱਡ ਦਿੱਤਾ ਸੀ ਥੋੜ੍ਹੇ ਸਮੇਂ ਲਈ ਕੀਤਾ ਸੀ ਇਸ ਕਰਕੇ ਮੈਨੂੰ ਹੁਣ ਕੁਝ ਇੰਨਾ ਉਸ ਬਾਰੇ ਯਾਦ ਨੀਗਾ ਥੋੜ੍ਹਾ ਬਹੁਤ ਹੀ ਆਉਂਦਾ ਹੈ ਅਤੇ ਮੈਂ ਇਹੀ ਸੁਝਾਅ ਦੇਣਾ ਚਾਹੁੰਗੀ ਕਿ ਅਗਰ ਤੁਸੀਂ ਕੋਈ ਕੰਮ ਸਿੱਖ ਰਹੇ ਹੋ ਤਾਂ ਉਹਦੀ ਪ੍ਰੈਕਟਿਸ ਉਹਦਾ ਅਭਿਆਸ ਜਿਹੜਾ ਉਹ ਲਗਾਤਾਰ ਕਰਦੇ ਰਹੋ ਇਹਦੇ ਨਾਲ ਕੀ ਹੋਊਗਾ ਕਿ ਤੁਹਾਨੂੰ ਕਦੀ ਵੀ ਉਹਦੀ ਜਾਂਚ ਨਹੀਂ ਭੁੱਲੇਗੀ ਜਿਸ ਤਰ੍ਹਾਂ ਹੁਣ ਸਿਲਾਈ ਦਾ ਕੰਮ ਹੈ ਅਗਰ ਸ਼ੁਰੂ ਕੀਤਾ ਸੀ ਤਾਂ ਮੈਂ ਹੁਣ ਤੱਕ ਉਹ ਕਰਦੀ ਹਾਂ ਅਤੇ ਉਹਦੀ ਮੈਨੂੰ ਜਾਂਚ ਵੀ ਆ ਪਰ ਜਿਹੜਾ ਬੁਣਨ ਦਾ ਕੰਮ ਆ ਉਹ ਮੈਂ ਥੋੜ੍ਹੇ ਸਮੇਂ ਲਈ ਸਿਰਫ ਉਦੋਂ ਉਦੋਂ ਹੀ ਕੀਤਾ ਸੀਗਾ ਜਿਸ ਕਰਕੇ ਕੀ ਹੋਇਆ ਕਿ ਹੁਣ ਮੈਨੂੰ ਉਹ ਚੰਗੀ ਤਰ੍ਹਾਂ ਕੰਮ ਨਹੀਂ ਆਉਂਦਾ ਮੈਂ ਅਜੇ ਵੀ ਉਹ ਕਰ ਸਕਦੀ ਹਾਂ ਪਰ ਕਿਤੇ ਨਾ ਕਿਤੇ ਮੈਨੂੰ ਉਸ ਵਿੱਚ ਮਦਦ ਦੀ ਲੋੜ ਪੈਂਦੀ ਆ ਪਰ ਸਿਲਾਈ ਵਿੱਚ ਮੈਨੂੰ ਮਦਦ ਦੀ ਲੋੜ ਨਹੀਂ ਪੈਂਦੀ ਇਸ ਤਰੀਕੇ ਨਾਲ ਮੈਂ ਇਹੋ ਸੁਝਾਅ ਦੇਣਾ ਚਾਹੁੰਗੀ ਕਿ ਜੋ ਤੁਸੀਂ ਕੰਮ ਕਰਨ ਲੱਗੋ ਉਹਨੂੰ ਪ੍ਰੋਪਰ ਕਰਦੇ ਰਹੋ ਜਿਨ੍ਹਾਂ ਤੀਕਰ ਜਾਂਚ ਨਹੀਂ ਆ ਜਾਂਦੀ ਛੱਡਣਾ ਨਹੀਂ ਚਾਹੀਦਾ ਵਿੱਚ ਇਹਦੇ ਨਾਲ ਕੀ ਹੋਊਗਾ ਕਿ ਤੁਹਾਡੀ ਕਲਾ ਵੀ ਜਿਹੜੀ ਉਹ ਨਿਖਰਦੀ ਆ ਅਤੇ ਤੁਸੀਂ ਉਹਦੇ ਵਿੱਚ ਹੋਰ ਵੀ ਮਾਹਿਰ ਹੁੰਦੇ ਹੋ